ਪਿਛਲੇ ਸਾਲਾਂ ਵਿੱਚ ਮੋਹਾਲੀ ਜ਼ਿਲ੍ਹੇ ਨੇ ਇੰਨੀ ਰਫਤਾਰ ਨਾਲ ਤਰੱਕੀ ਕੀਤੀ ਹੈ ਕਿ ਇਸ ਨੇ ਆਪਣਾ ਸਭ ਕੁਝ ਗਵਾ ਵੀ ਲਿਆ ਏ ਅਤੇ ਕੁਛ ਨਾ ਕੁਛ ਪਾ ਵੀ ਲਿਆ ਹੈ ਇੱਥੋਂ ਦੇ ਲੋਕ ਬਹੁਤ ਅਗਾਂਹ ਵੱਧ ਸੋਚ ਵਾਲੇ ਹੋ ਗਏ ਹਨ ਇੱਥੇ ਪਿੰਡ ਅਲੋਪ ਹੋ ਰਹੇ ਹੈ ਹੌਲ਼ੀ ਹੌਲ਼ੀ ਅਤੇ ਸ਼ਹਿਰੀਕਰਨ ਵੱਧ ਰਿਹਾ ਹੈ ਇੱਥੇ ਦੀ ਵਾਹੀਯੋਗ ਜ਼ਮੀਨ ਵੀ ਬਹੁਤ ਮਤਲਬ ਵੇਸਟ ਜਾ ਰਹੀ ਹੈ ਬੜੀਆਂ ਵੱਡੀਆਂ ਬਿਲਡਿੰਗਾਂ ਬੜੇ ਬੜੇ ਹੋਟਲ ਬੜੀਆਂ ਵੱਡੀਆ ਆਪਣੇ ਰਹਿਣ ਦੀਆਂ ਸਥਾਨ ਬਣ ਰਹੇ ਹਨ ਕੋਠੀਆਂ ਲੋਕਾਂ ਕੋਲ਼ ਇੱਥੇ ਤਰੱਕੀ ਇੰਨੀ ਜ਼ਿਆਦਾ ਹੈ ਘਰ ਘਰ ਵਿੱਚ ਦੋ ਦੋ ਕਾਰਾਂ ਖੜ੍ਹੀਆਂ ਹਨ ਅਤੇ ਬੁਨਿਆਦੀ ਢਾਂਚਾ ਇੱਥੋਂ ਦਾ ਜੋ ਪਿੰਡਾਂ ਦਾ ਸੀ ਉਹ ਬਹੁਤ ਬਦਲ ਚੁੱਕਿਆ ਹੈ ਪਿੰਡਾਂ ਦੇ ਲੋਕ ਵੀ ਸ਼ਹਿਰੀਕਰਨ ਵਿੱਚ ਇਸ ਤਰ੍ਹਾਂ ਢੰਗ ਨਾਲ ਢਲਦੇ ਜਾ ਰਹੇ ਹਨ ਕਿ ਜਿਵੇਂ ਉਹ ਪ ਪਹਿਲਾਂ ਪ ਪੰਜਾਹ ਸੱਠ ਸਾਲਾਂ ਤੋਂ ਸ਼ਹਿਰਾਂ ਵਿੱਚ ਹੀ ਰਹਿੰਦੇ ਹੋਣ ਇਸ ਇਸ ਦੇ ਨੁਕਸਾਨ ਵੀ ਬਹੁਤ ਹਨ ਇਸਦੇ ਨਾਲ ਕ੍ਰਾਇਮ ਕਰੂਮ ਨੂੁੰ ਬਹੁਤ ਜ਼ਿਆਦਾ ਬਢਾਵਾ ਮਿਲ ਰਿਹਾ ਹੈ ਜਿਹਦੇ ਕਰਕੇ ਸ਼ਹਿਰਾਂ ਬਹੁਤ ਸ਼ਹਿਰ ਵਿੱਚ ਬਹੁਤ ਜ਼ਿਆਦਾ ਕ੍ਰਾਇਮ ਹੁੰਦਾ ਹੈ ਮੋਹਾਲੀ ਸ਼ਹਿਰ ਮੋਹਾਲੀ ਜ਼ਿਲ੍ਹੇ ਨੇ ਤਰੱਕੀ ਵੀ ਬਹੁਤ ਕੀਤੀ ਹੈ ਪਰ ਨਾਲ ਨਾਲ ਇਸ ਦੇ ਨਾਲ ਪੇਂਡੂ ਖੇਤਰ ਦਾ ਵੀ ਬਹੁਤ ਨੁਕਸਾਨ ਕੀਤਾ ਹੈ